ਭਾਰਤ ਵਿੱਚ ਬਹੁਤ ਸਾਰੇ ਤਿਉਹਾਰ ਹਨ ਜਿਵੇਂ ਕਿ ਮੈਂ ਤੁਹਾਨੂੰ ਨਾਮ ਲੈ ਕੇ ਉਹਨਾਂ ਦਾ ਦੱਸਦੀ ਹਾਂ ਦਿਵਾਲੀ ਵਿਸਾਖੀ ਲੋਹੜੀ ਹੋਲੀ ਵਿਸ਼ਕਰਮਾ ਡੇ ਨਵਰਾਤੇ ਦੁਸ਼ਹਿਰਾ ਕਰਵਾਚੌਥ ਹੋਰ ਵੀ ਬਹੁਤ ਕੁਛ ਨੇ ਜਿੱਦਾਂ ਗਾਂਧੀ ਜੈਯੰਤੀ ਵੀ ਮਨਵਾ ਮਨਾਈ ਜਾਂਦੀ ਆ ਅਤੇ ਇੰਡੀਪੈਂਡੈਂਟਸ ਡੇ ਜਿਸ ਜਿੱਦਣ ਭਾਰਤ ਨੂੰ ਸੁ ਸੁਤੰਤਰਤਾ ਮਿਲੀ ਸੀ ਦੇਸ਼ ਨੂੰ ਆਜ਼ਾਦ ਦੇਸ਼ ਆਜ਼ਾਦ ਹੋਇਆ ਸੀ ਅਤੇ ਛੱਬੀ ਜਨਵਰੀ ਨੂੰ ਵੀ ਛੁੱਟੀ ਹੁੰਦੀ ਆ ਜਿੱਦਣ ਆਪਣਾ ਭਾਰਤ ਦਾ ਕੋਨਸਟੀਟਿਊਸ਼ਨ ਬਣਿਆ ਸੀ ਅਤੇ ਇੱਦਾਂ ਦੇ ਵੀ ਹੋਰ ਬਹੁਤ ਸਾਰੇ ਤਿਉਹਾਰ ਹਨ ਜਾਂ ਬਹੁਤ ਸਾਰੇ ਡੇਟਸ ਹਨ ਜਾਂ ਸਾਇੰਟਿਸਟ ਜਨਮਦਿਨ ਹੋਣ ਜਾਂ ਉੱਦਾਂ ਕੋਈ ਆਪਣੇ ਦੇਸ਼ ਪੀਰ ਭਗਤ ਜਿਹੜੇ ਨੇ ਉਹਨਾਂ ਦੇ ਜਨਮ ਦਿਨ ਆਉਂਦੇ ਉਹਨਾਂ 'ਤੇ ਵੀ ਛੁੱਟੀ ਹੁੰਦੀ ਆ ਅਤੇ ਹੁਣ ਜੇ ਮੈਂ ਪਰਟੀਕੁਲਰ ਗੱਲ ਕਰਾਂ ਤਾਂ ਮਨ ਮੇਰਾ ਮਨਪਸੰਦ ਤਿਉਹਾਰ ਹੈ ਦੀਵਾਲੀ ਦੇ ਵਿੱਚ ਆਪਾਂ ਨਵੇਂ ਨਵੇਂ ਕੱਪੜੇ ਪਾਈਦੇ ਆ ਮਿਠਾਈ ਖਾਈ ਦੀ ਆ ਉਸ ਦਿਨ ਵਧੀਆ ਵਧੀਆ ਚੀਜ਼ਾਂ ਖਾਈ ਦੀਆਂ ਪਕੌੜੇ ਖਾਈਦੇ ਆ ਐਂਡ ਸਾਰਾ ਕੁਛ ਲਾਈਕ ਘਰ ਸਜਾਉਂਦੇ ਆ ਲੋਕ ਆਪਣੇ ਅਤੇ ਦਿਵਾਲੀ ਤੋਂ ਵੀਹ ਦਿਨ ਪਹਿਲਾਂ ਦਵਾਈ ਦਿਵਾਲੀ ਦੀਆਂ ਸਫ਼ਾਈਆਂ ਸ਼ੁਰੂ ਹੋ ਜਾਂਦੀਆਂ ਉੱਦਣ ਦੁਸਹਿਰਾ ਹੁੰਦਾ ਆ ਵੀਹ ਦਿਨ ਪਹਿਲਾਂ ਅਤੇ ਉਸ ਤੋਂ ਬਾਅਦ ਘਰ ਦੀ ਸਫ਼ਾਈ ਕਰਦੇ ਆ ਸਾਰੇ ਤਾਂ ਕਿ ਲਕਸ਼ਮੀ ਮਾਤਾ ਆਉਣ ਅਤੇ ਆਪਾਂ ਸਾਰੇ ਉਹਨਾਂ ਦੀ ਪੂਜਾ ਕਰਦੇ ਹਾਂ ਅਤੇ ਬਹੁਤ ਸਾਰੇ ਬਹੁਤ ਖੁਸ਼ ਹੁੰਦੇ ਆ ਜਦੋਂ ਦਿਵਾਲੀ ਦਾ ਤਿਉਹਾਰ ਆਉਂਦਾ ਆ ਸਾਰਾ ਭਾਰਤ ਦਿਵਾਲੀ ਦਾ ਤਿਉਹਾਰ ਮਨਾਉਂਦਾ ਆ ਕੋਈ ਵੀ ਐਸਾ ਬੰਦਾ ਨਹੀਂ ਹੁੰਦਾ ਜਿਹੜਾ ਦਿਵਾਲੀ ਨਹੀਂ ਮਨਾਉਂਦਾ ਅਤੇ ਇਹ ਸਾਰੇ ਧਰਮਾਂ ਦੇ ਲੋਕ ਦਿਵਾਲੀ ਮਨਾਉਂਦੇ ਆ ਅਤੇ ਸਾਰੇ ਬਹੁਤ ਖੁਸ਼ ਹੁੰਦੇ ਆ ਥੈਂਕ ਯੂ